ਹਰੇਕ ਜ਼ਿਲ੍ਹੇ ਵਿੱਚ ਆਪਣੇ ਅਲੱਗ ਅਲੱਗ ਕੁਦਰਤੀ ਸਰੋਤ ਨੇ ਪਟਿਆਲੇ ਵਿੱਚ ਅਲੱਗ ਨੇ ਲੁਧਿਆਣੇ ਵਿੱਚ ਅਲੱਗ ਨੇ ਅਤੇ ਹੋਰ ਕਾਫੀ ਜ਼ਿਲ੍ਹਿਆਂ ਵਿੱਚ ਆਪਣੇ ਆਪਣੇ ਕਾਫੀ ਸਾਰੇ ਕੁਦਰਤੀ ਸਰੋਤ ਪਾਏ ਜਾਂਦੇ ਨੇ ਗੇ ਇਹਨਾਂ ਵਿੱਚ ਜੰਗਲ ਪਾਣੀ ਅਤੇ ਖਣਿਜ ਵਸਤੂਆਂ ਆਦਿ ਵੀ ਪਾਈਆਂ ਜਾਂਦੀਆਂ ਨੇਗੀਆਂ ਪਟਿਆਲੇ ਦੀ ਜਿਹੜੀ ਹੈ ਕਾਫੀ ਸਾਫ ਸਫਾਈ ਵਿੱਚ ਅਸੀਂ ਕਾਫੀ ਬਦਲਾਅ ਦੇਖੇ ਨੇ ਇੱਥੇ ਜਿਹੜੀ ਭਾਖੜਾ ਦਾ ਪਾਣੀ ਆ ਉਹਨੂੰ ਕਾਫੀ ਤਰੀਕੇ ਨਾਲ ਕੀ ਜਿਹੜਾ ਫਿਲਟਰ ਕੀਤਾ ਜਾ ਰਿਹਾ ਤਾਂ ਕਿ ਉਹ ਟੂਟੀਆਂ ਵਿੱਚ ਕਾਫੀ ਵਧੀਆ ਤਰੀਕੇ ਦਾ ਪਾਣੀ ਦੇ ਸਕਣ ਅਤੇ ਲੋਕ ਕਾਫੀ ਬਿਮਾਰੀਆਂ ਤੋਂ ਬਚ ਸਕਦੇ ਨੇ ਗੇ ਜਿਹੜੀ ਨਗਰਪਾਲਿਕਾ ਇਹ ਵੀ ਇਹਦੇ ਵਿੱਚ ਇਹਦੇ ਖੇਤਰ ਨੂੰ ਵਧਾਉਣ ਲਈ ਅਤੇ ਇਹਦੀ ਸਫਾਈ ਲਈ ਕਾਫੀ ਯੋਜਨਾਵਾਂ ਕਰ ਰਹੀ ਹੈ ਅਤੇ ਕਾਫੀ ਇਹ ਕੂੜੇ ਦੇ ਢੇਰਾਂ ਨੂੰ ਵੀ ਚੱਕਦੀ ਹੈ ਕਿਉਂਕਿ ਕਾਫੀ ਲੋਕ ਨੇ ਜਿਹੜੇ ਕਿ ਓਹ ਗੰਦਗੀ ਫੈਲਾਉਂਦੇ ਨੇ ਗੇ ਪਟਿਆਲੇ ਦੀ ਜਿਹੜੀ ਵੱਡੀ ਨਦੀ ਆ ਉਹਦੇ ਵਿੱਚ ਵੀ ਕਾਫੀ ਕੂੜਾ ਕਰਕਟ ਫੈਲਿਆ ਹੋਇਆ ਸੀ ਪਰ ਹੁਣ ਜਦੋਂ ਕਿ ਹੜ੍ਹ ਆਇਆ ਸੀ ਤਾਂ ਉਹਨਾਂ ਦੀ ਕਾਫੀ ਇਹਨਾਂ ਨੇ ਸਫਾਈ ਕੀਤੀ ਹੈ ਅਤੇ ਮੈਨੂੰ ਉਮੀਦ ਹੈ ਕਿ ਅੱਗੇ ਵੀ ਇਹ ਕਾਫੀ ਤਰ੍ਹਾਂ ਦੀ ਸਫਾਈ ਕਰਦੇ ਰਹਿਣਗੇ ਅਤੇ ਇਹਨਾਂ ਨੇ ਪਰਾਲੀ ਨੂੰ ਸਾੜਨ ਨਾ ਸਾੜਨ ਲਈ ਵੀ ਕਾਫੀ ਉਪਰਾਲੇ ਕੀਤੇ ਨੇ ਜਿਹੜੇ ਕਿ ਕਿਸਾਨ ਨੇ ਉਹ ਪਰਾਲੀ ਨੂੰ ਸਾੜਦੇ ਸੀਗੇ ਇਹਨਾਂ ਨੇ ਹੁਣ ਕਾਫੀ ਹੀ ਯੋਜਨਾਵਾਂ ਚਲਾਈਆਂ ਨੇ ਜਿਹਨਾਂ ਜਿਹਨਾਂ ਪਰਾਲੀ ਨੂੰ ਨਹੀਂ ਸਾੜਿਆ ਜਾਂਦਾ ਹੈਗਾ ਤਾਂ ਕਰਕੇ ਕੀ ਹੈ ਜਿਹੜੇ ਸਾਡਾ ਵਾਤਾਵਰਨ ਆ ਉਹ ਪ੍ਰਦੂਸ਼ਿਤ ਨਹੀਂ ਹੁੰਦਾ ਹੈਗਾ ਅਤੇ ਅਸੀਂ ਇੱਕ ਜਿਹੜੇ ਕਿ ਸੇਫ ਇਨਵਾਰਮੈਂਟ 'ਚ ਰਹਿ ਸਕਦੇ ਹਾਂ ਅਤੇ ਇਹਨੂੰ ਅਸੀਂ ਈਕੋ ਫਰੈਂਡਲੀ ਬਣਾ ਕੇ ਅਸੀਂ ਇਹ ਜਿਹੜੀ ਆਪਣੀ ਲਾਈਫ ਸਟਾਇਲ ਹੈ ਇਹਨੂੰ ਅਸੀਂ ਵਧੀਆ ਤਰੀਕੇ ਨਾਲ ਕੀ ਹੈ ਕਿਸੇ ਅੱਗੇ ਪ੍ਰੀਜੈਂਟ ਕਰ ਸਕਦੇ ਹਾਂ